ਟੈਕਨੋਲੋਜੀ ਨੇ ਛੋਟੇ ਕਾਰੋਬਾਰਾਂ ਦੇ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਨਵੀਂ ਟੈਕਨੋਲੋਜੀ ਦੇ ਆਉਣ ਦੇ ਨਾਲ ਜਿਹੜੇ ਛੋਟੇ ਕਾਰੋਬਾਰ ਹਨ ਉਹਨਾਂ ਦੀ ਵੀ ਗ੍ਰੋਥ ਹੋਈ ਹੈ ਜਿਵੇਂ ਕਿ ਮੈਂ ਆਪਣੀ ਇਗਜਾਮਪਲ ਦੇ ਕੇ ਦੱਸਾਂਗੀ ਮੈਂ ਇੱਕ ਟਿਊਸ਼ਨ ਸੈਂਟਰ ਪੜ੍ਹਾਉਂਦੀ ਹਾਂ ਅਤੇ ਮੈਂ ਫਿਜੀਕਲੀ ਬੱਚਿਆਂ ਨੂੰ ਜਦੋਂ ਪੜ੍ਹਾਉਂਦੀ ਹਾਂ ਤਾਂ ਜਦੋਂ ਕਰੋਨਾ ਦਾ ਟਾਈਮ ਸੀ ਤਾਂ ਮੈਂ ਟੈਕਨੋਲੋਜੀ ਦੀ ਵਰਤੋਂ ਦੇ ਨਾਲ ਬੱਚਿਆਂ ਨੂੰ ਔਨਲਾਈਨ ਕਲਾਸਾਂ ਦੇਣਾ ਸ਼ੁਰੂ ਕੀਤੀਆਂ ਜਦੋਂ ਮੈਂ ਔਨਲਾਈਨ ਕਲਾਸਿਜ ਦੇਣੀਆਂ ਸ਼ੁਰੂ ਕੀਤੀਆਂ ਤਾਂ ਬੱਚੇ ਦੀ ਗਿਣਤੀ ਵੀ ਵੱਧ ਗਈ ਅਤੇ ਇਹਦੇ ਨਾਲ ਮੇਰਾ ਵੀ ਵਿਕਾਸ ਹੋਇਆ ਅਤੇ ਮੈਂ ਇਸ ਦੇ ਨਾਲ ਨਾਲ ਹੀ ਆਪਣਾ ਨਵਾਂ ਯੂਟਿਊਬ ਚੈਨਲ ਵੀ ਖੋਲ੍ਹਿਆ ਅਤੇ ਯੂਟਿਊਬ ਦੇ ਚੈਨਲ ਦੇ ਨਾਲ ਵੀ ਹੁਣ ਮੈਂ ਬਹੁਤ ਵਧੀਆ ਅਰਨ ਕਰ ਲੈਂਦੀ ਹਾਂ ਇਹ ਕੇਵਲ ਟਿਊਸ਼ਨ ਸੈਂਟਰ ਦੇ ਲੋਕਾਂ ਦੇ ਲਈ ਨਹੀਂ ਵਧੀਆ ਨਵੀਂ ਟੈਕਨੋਲਜੀ ਦੇ ਨਾਲ ਜਿਹੜੇ ਛੋਟੇ ਕਾਰੋਬਾਰ ਦੇ ਦੁਕਾਨਦਾਰ ਹਨ ਜਿਹੜੇ ਕਿ ਕੱਪੜਿਆਂ ਦੀਆਂ ਦੁਕਾਨਾਂ ਹਨ ਉਹ ਜਾ ਕੇ ਮੀਸ਼ੋ ਵਰਗਿਆਂ 'ਤੇ ਵੀ ਆਪਣੇ ਜਿੱਦਾਂ ਵੇਚ ਸਕਦੇ ਹਨ ਨਵੀਂ ਟੈਕਨੋਲੋਜੀ ਦੇ ਨਾਲ ਉਹ ਆਪਣੇ ਕਾਰੋਬਾਰ ਨੂੰ ਵਧਾਉਂਦੇ ਹਨ ਉਹਨਾਂ ਨੇ ਔਨਲਾਈਨ ਵੀ ਆਪਣਾ ਕੰਮ ਸ਼ੁਰੂ ਕਰ ਲਿਆ ਹੈ ਜਿਸ ਦੇ ਨਾਲ ਛੋਟੇ ਕਾਰੋਬਾਰਾਂ ਨੂੰ ਵੀ ਵਧਣ ਵਿੱਚ ਸਹਾਇਤਾ ਮਿਲੀ ਹੈ ਉਹ ਵੀ ਨਵੀਂ ਟੈਕਨੋਲੋਜੀ ਦੇ ਕਾਰਨ